ਪਿਛਲੇ ਮਹੀਨੇ ਮੈਂ ਐਮਾਜ਼ੋਨ ਐਪ ਤੋਂ ਇੱਕ ਸਮਾਰਟ ਫ਼ੋਨ ਮੰਗਵਾਇਆ ਜਿਸਦਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਪੋਜ਼ੀਟਿਵ ਰਿਹਾ ਮੈਂ ਇਹ ਐਪਲੀਕੇਸ਼ਨ ਨੂੰ ਜਦੋਂ ਓਪਨ ਕਰਕੇ ਸਮਾਰਟਫ਼ੋਨ ਦਾ ਸਰਚ ਇੰਜਨ ਉੱਤੇ ਭਰਿਆ ਤਾਂ ਇੱਥੇ ਬਹੁਤ ਹੀ ਪ੍ਰਕਾਰ ਦੇ ਸਮਾਰਟਫ਼ੋਨ ਆ ਗਏ ਅਤੇ ਉਹਨਾਂ ਦੀਆਂ ਵਿਸ਼ੇਸਤਾਵਾਂ ਅਤੇ ਕੀ ਸਟੋਰੇਜ ਰੈਮ ਸੀ ਉਹ ਵੀ ਨਾਲ ਲਿਖਿਆ ਆ ਰਿਹਾ ਸੀ ਬਹੁਤ ਟਾਈਮ ਸਰਚ ਕਰਨ ਤੋਂ ਬਾਅਦ ਅਤੇ ਉਹਨਾਂ ਦੀ ਸਾਰੀਆਂ ਪਰਮਿਸ਼ਨ ਪੜ੍ਹਨ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਕੋਈ ਉਪੋ ਕੰਪਨੀ ਦਾ ਫ਼ੋਨ ਲੈਣਾ ਹੈ ਤਾਂ ਮੈਨੂੰ ਇੱਕ ਨਿਊ ਟਵੰਟੀ ਟਵੰਟੀ ਥਰੀ ਮੋਡਲ ਓਪੋ ਐੱਫ ਟਵੰਟੀ ਥਰੀ ਫ਼ੋਨ ਦਿਖਿਆ ਜੋ ਕਿ ਬਹੁਤ ਹੀ ਰੰਗਾਂ ਵਿੱਚ ਉੱਥੇ ਪ੍ਰੈਜੈਂਟ ਸੀ ਬਟ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਗੋਲਡਨ ਕਲਰ ਨੇ ਕੀਤਾ ਅਤੇ ਮੈਨੂੰ ਇਹ ਬਹੁਤ ਹੀ ਜ਼ਿਆਦਾ ਪਸੰਦ ਆਇਆ ਇਸ ਦਾ ਪ੍ਰਾਈਜ਼ ਲਗਭਗ ਤੇਈ ਹਜ਼ਾਰ ਦੇ ਕਰੀਬ ਸੀ ਅਤੇ ਮੈਂ ਸੋਚਿਆ ਕਿ ਐਨਾ ਕੁ ਤਾਂ ਮੇਰਾ ਬਜ਼ਟ ਵੀ ਹੈ ਕਿਉਂ ਨਾ ਇਸ ਫ਼ੋਨ ਬਾਰੇ ਹੀ ਗੂਗਲ ਉੱਤੋਂ ਵੀ ਭਰਿਆ ਜਾਵੇ ਪੜ੍ਹਿਆ ਜਾਵੇ ਤਾਂ ਮੈਂ ਗੂਗਲ ਉੱਤੇ ਭਰ ਕੇ ਬਹੁਤ ਚੀਜ਼ਾਂ ਦੇਖੀਆਂ ਕਿ ਇਸਦੀ ਅੱਠ ਜੀ ਬੀ ਰੈਮ ਅਤੇ ਵ ਦੋ ਸੌ ਛਪੰਜਾ ਜੀ ਬੀ ਸਟੋਰੇਜ਼ ਹੈ ਤਾਂ ਮੈਨੂੰ ਇਹ ਬਹੁਤ ਹੀ ਜ਼ਿਆਦਾ ਵਧੀਆ ਅਤੇ ਪੈਸੇ ਦਾ ਮੁੱਲ ਇਫੈਕਟਿਵ ਲੱਗਾ ਤਾਂ ਮੈਂ ਇਹ ਫ਼ੋਨ ਨੂੰ ਔਡਰ ਕਰ ਦਿੱਤਾ ਅਤੇ ਇਸਦੇ ਵਿੱਚ ਦੋ ਔਪਸ਼ਨਾਂ ਮਿਲ ਰਹੀਆਂ ਸੀ ਜਿਸਦੇ ਵਿੱਚੋਂ ਇੱਕ ਨੋਰਮਲ ਡਿਲੀਵਰੀ ਅਤੇ ਇੱਕ ਫਾਸਟਿਸ ਡਿਲੀਵਰੀ ਸੀ ਮੈਂ ਫਾਸਿਸਟ ਡਿਲੀਵਰੀ 'ਤੇ ਕਲਿੱਕ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਇਸਦੇ ਲਈ ਮੈਨੂੰ ਸੌ ਰੁਪਇਆ ਜ਼ਿਆਦਾ ਪੇਅ ਕਰਨਾ ਪਵੇਗਾ ਅਤੇ ਫਿਰ ਮੈਂ ਉਹ ਵੀ ਪੇਅ ਕਰ ਦਿੱਤਾ ਅਤੇ ਮੈਂ ਇਸ ਵਾਸਤੇ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ ਅਤੇ ਜਦੋਂ ਫ਼ੋਨ ਮੇਰੇ ਘਰ ਪਹੁੰਚਿਆ ਡਿਲੀਵਰੀ ਵਾਲੇ ਨੂੰ ਮੈਂ ਉੱਥੇ ਹੀ ਖੜ੍ਹਾ ਕੇ ਰੱਖਿਆ ਅਤੇ ਉਸਦੇ ਸਾਹਮਣੇ ਹੀ ਮੈਂ ਓਪਨ ਕੀਤਾ ਤਾਂ ਇਹ ਫ਼ੋਨ ਬਹੁਤ ਹੀ ਜ਼ਿਆਦਾ ਵਧੀਆ ਸੀ ਅਤੇ ਮੈਂ ਹੁਣ ਇਸ ਦਾ ਵ ਇਸਤੇਮਾਲ ਕਰਦੀ ਹਾਂ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਇਸ ਫ਼ੋਨ ਦੇ ਵਿੱਚ ਜੋ ਵੀ ਕੁਆਲਿਟੀਜ਼ ਹਨ ਜਿਵੇਂ ਕਿ ਕੈਮਰਾ ਕੁਆਲਿਟੀਜ਼ ਮਿਊਜ਼ਿਕ ਕੁਆਲਿਟੀ ਕੈਮਰਾ ਅਤੇ ਹੋਰ ਵੀ ਪ੍ਰਕਾਰ ਦੀਆਂ ਕੁਆਲਿਟੀਜ਼ ਬਹੁਤ ਹੀ ਜ਼ਿਆਦਾ ਵਧੀਆ ਹਨ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਫ਼ੋਨ ਨੂੰ ਬਾਏ ਕੀਤਾ ਅਤੇ ਇਸਦਾ ਐਕਸਪੀਰੀਅੰਸ ਮੇਰੇ ਵਾਸਤੇ ਬਹੁਤ ਪੋਜ਼ੀਟਿਵ ਰਿਹਾ